ਮੈਂ ਅੰਸ਼ੁਲ ਅਤੇ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਚਿੱਤਰਕਾਰੀ ਕਰਨਾ ਬਹੁਤ ਪਸੰਦ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਚਿੱਤਰਕਾਰੀ ਕਰਦੇ ਸਮੇਂ ਮੈਂ ਕਿਸ ਕਿਸਮ ਦੀ ਸਪਲਾਈ ਦੀ ਵਰਤੋਂ ਕਰਨਾ ਪਸੰਦ ਕਰਦਾ ਹਾਂ ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਵੇਂ ਕਿ ਮੈਂ ਚਿੱਤਰਕਾਰੀ ਕਰਦੇ ਸਮੇਂ ਸਭ ਤੋਂ ਪਹਿਲਾਂ ਤਾਂ ਚਾਰਟ ਦਾ ਇਸਤੇਮਾਲ ਕਰਦਾ ਹਾਂ ਫਿਰ ਉਸ ਤੋਂ ਬਾਅਦ ਕਈ ਕਿਸਮ ਦੀਆਂ ਬਰਸ਼ ਵਗੈਰਾ ਈਰੇਜ਼ਰ ਸ਼ੋਪਨਰ ਪੈਂਸਿਲ ਆਦਿ ਦਾ ਇਸਤੇਮਾਲ ਕਰਦਾ ਹਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਵਾਂਗਾ ਕਿ ਇਹਨਾਂ ਦੇ ਕਾਫੀ ਬ੍ਰੈਂਡ ਮਾਰਕੀਟ ਵਿੱਚ ਮੌਜੂਦ ਨੇ ਪਰ ਮੈਂ ਕੁਝ ਚੁਨਿੰਦਾ ਬ੍ਰੈਂਡ ਨੂੰ ਪਸੰਦੀਦਾ ਬ੍ਰੈਂਡ ਮੰਨਦਾ ਹਾਂ ਜਿਵੇਂ ਕਿ ਡੋਮਸ ਦਾ ਬ੍ਰੈਂਡ ਕਲਾਸਮੇਟ ਦਾ ਬ੍ਰੈਂਡ ਫਿਰ ਕੈਮਲੀਨ ਦਾ ਬ੍ਰੈਂਡ ਆਦਿ ਇਹ ਕੁਝ ਮੇਰੇ ਪਸੰਦੀਦਾ ਬ੍ਰੈਂਡ ਨੇ ਜਿਨ੍ਹਾਂ ਦੀ ਸਪਲਾਈ ਮੈਂ ਆਪਣੇ ਚਿੱਤਰਕਾਰੀ ਕਰਦੇ ਸਮੇਂ ਵਰਤੋਂ ਕਰਦਾ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਵਾਂਗਾ ਕਿ ਇਸ ਨੂੰ ਮੈਂ ਆਪਣੇ ਘਰ ਦੇ ਆਲੇ ਦੁਆਲੇ ਜਾਂ ਨੇੜੇ ਤੋਂ ਮੇਰੇ ਘਰ ਦੇ ਆਲੇ ਦੁਆਲੇ ਅਤੇ ਨੇੜੇ ਵਿੱਚ ਕੁਝ ਜੋ ਸਟੇਸ਼ਨਰੀ ਦੀਆਂ ਦੁਕਾਨਾਂ ਨੇ ਉਹ ਉੱਥੋਂ ਖਰੀਦਣਾ ਹਾਂ ਖਰੀਦਣਾ ਅਤੇ ਜਿਵੇਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਜੇ ਮੈਨੂੰ ਇਹ ਆਈਟਮ ਸਟੇਸ਼ਨਰੀ ਦੁਕਾਨ ਤੋਂ ਨਹੀਂ ਉਪਲਬਧ ਹੁੰਦੀ ਤਾਂ ਇਸ ਨੂੰ ਮੈਂ ਕਦੇ ਕਦੇ ਔਨਲਾਈਨ ਔਡਰ ਕਰਦਾ ਹਾਂ ਅਤੇ ਇੱਕ ਹੋਰ ਗੱਲ ਕਿ ਮੈਨੂੰ ਲੱਗਦਾ ਹੈ ਕਿ ਇਹ ਸਪਲਾਈ ਜਾਂ ਸਟੇਸ਼ਨਰੀ ਦਾ ਸਮਾਨ ਥੋੜ੍ਹਾ ਮਹਿੰਗਾ ਹੈ ਅਤੇ ਇਸ ਦੇ ਰੇਟ ਥੋੜ੍ਹੇ ਘਟਣੇ ਚਾਹੀਦੇ ਹਨ